ਸਾਡੇ ਸਕੂਲ ਵਾਲਿਆਂ ਨੇ ਸਾਡੇ ਟਰਿੱਪ ਲਈ ਔਰਗਨਾਈਜ਼ ਕੀਤਾ ਜੋ ਕਿ ਚੰਡੀਗੜ ਜਾ ਰਿਹਾ ਸੀ ਸਾਡੇ ਅਧਿਆਪਕ ਸਾਹਿਬਾਨ ਨੇ ਸਾਨੂੰ ਕੰਨਸਰਟ ਫੋਮ ਦਿੱਤਾ ਅਤੇ ਸਾਡੇ ਅਧਿਆਪਕ ਨੇ ਕਿਹਾ ਵੀ ਮਾਪਿਆਂ ਦੀ ਪਰਮੀਸ਼ਨ ਲੈਣੀ ਹੈ ਅਤੇ ਫਿਰ ਅਸੀਂ ਸਾਡੇ ਮਾਪਿਆਂ ਨੇ ਪਰ ਪਰਮੀਸ਼ਨ ਦੇ ਦਿੱਤੀ ਫਿਰ ਅਸੀਂ ਚਲੋ ਫਿਰ ਅਸੀਂ ਚੰਡੀਗੜ੍ਹ ਜਾਣ ਦੇ ਲਈ ਤਿਆਰ ਹੋ ਗਏ ਅਤੇ ਅਸੀਂ ਅਗਲੇ ਦਿਨ ਜਾ ਕੇ ਮੈਮ ਨੂੰ ਕੰਨਸਰਟ ਫੋਮ ਜਮ੍ਹਾਂ ਕਰਾ ਤਾ ਫਿਰ ਸਾਡੇ ਮੈਮ ਨੇ ਕਿਹਾ ਵੀ ਤੁਸੀਂ ਸੱਤ ਵਜੇ ਆਉਣਾ ਹੈ ਅਤੇ ਵੀ ਉਰੋਂ ਦੀ ਬੱਸ ਸਾਡੇ ਸਕੂਲ ਦੇ ਬਾਹਰ ਬੱਸ ਜਾਏਗੀ ਅਸੀਂ ਲੰਘ ਗਏ ਸੱਤ ਵਜੇ ਪਹੁੰਚ ਗਏ ਅਤੇ ਸੱਤ ਵਜੇ ਜਾ ਕੇ ਦੇਖਿਆ ਤਾਂ ਸਾਡੇ ਸਕੂਲ ਦੀ ਟਰਿੱਪ ਵਾਲੀ ਬੱਸ ਕੀਤੀ ਹੋਈ ਸੀਗੀ ਉਹ ਉੱਥੇ ਸਮੇਂ ਸਿਰ ਆ ਗਈ ਸੀਗੀ ਫਿਰ ਅਸੀਂ ਹੌਲੀ ਹੌਲੀ ਕਰਕੇ ਮੈਮ ਨੇ ਸ ਸਾਰੇ ਬੱਚਿਆਂ ਨੂੰ ਲਾਇਨ ਵਿੱਚ ਖੜ੍ਹਾ ਕੇ ਕਾਊਂਟਿੰਗ ਕਰੀ ਅਤੇ ਫਿਰ ਬੱਚਿਆਂ ਨੂੰ ਬੱਸ ਵਿੱਚ ਚੜ੍ਹਾ ਤਾ ਅਤੇ ਫਿਰ ਅਸੀਂ ਜਦ ਸਾਡੀ ਬਸ ਤੁਰ ਪਈ ਟਰਿੱਪ ਜਾਣ ਲਈ ਅਤੇ ਜਦ ਅਸੀਂ ਚੰਡੀਗੜ੍ਹ ਦੇ ਸ਼ੁਰੂਆਤ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਅਤੇ ਅਸੀਂ ਦੋ ਘੰਟੇ ਬਾਅਦ ਗੁਰਦੁਆਰੇ ਪਹੁੰਚ ਗਏ ਅਤੇ ਅਸੀਂ ਗੁਰਦੁਆਰੇ ਵਿੱਚ ਮੱਥਾ ਟੇਕਿਆ ਅਤੇ ਫਿਰ ਅਸੀਂ ਅੱਗੇ ਜਾ ਕੇ ਫਿਰ ਗੁਰਦੁਆਰੇ 'ਚ ਮੱਥਾ ਟੇਕ ਕੇ ਫਿਰ ਅਸੀਂ ਅੱਗੇ ਇੱਕ ਸੈਲੂਨ 'ਚ ਵਿਜ਼ੀਟ ਵੀ ਕੀਤਾ ਸੈਲੂਨ 'ਚ ਬਹੁਤ ਹੀ ਵਧੀਆ ਤਰ੍ਹਾਂ ਨਾਲ ਜਿਹੜੇ ਉੱਥੇ ਸੈਲੂਨ ਦੇ ਵਰਕਰ ਸੀਗੇ ਬ ਬਹੁਤ ਹੀ ਵਧੀਆ ਸਾਰਾ ਕੰਮ ਕਰ ਰਹੇ ਸੀਗੇ ਅਤੇ ਉਸ ਤੋਂ ਬਾਅਦ ਅਸੀਂ ਸੁਖਨਾ ਝੀਲ ਵੀ ਗਏ ਅਤੇ ਫਿਰ ਅਸੀਂ ਸੁਖਨਾ ਝੀਲ ਗਏ ਸੁਖਨਾ ਝੀਲ ਵਿੱਚ ਬਹੁਤ ਹੀ ਵਧੀਆ ਲੋਕ ਬੋ ਬੋਟਿੰਗ ਵੀ ਕਰ ਰਹੇ ਸੀਗੇ ਸਾਨੂੰ ਦੇਖ ਕੇ ਬਹੁਤ ਹੀ ਅੱਛਾ ਲੱਗਿਆ ਉੱਥੇ ਸਾਡੇ ਮੈਮ ਨੇ ਸਾਨੂੰ ਬਿਠਾ ਕੇ ਫੋਟੋ ਵੀ ਲਈ ਸਾਡੀ ਅਤੇ ਉਸ ਤੋਂ ਬਾਅਦ ਅਸੀਂ ਇੱਕ ਬਰਡ ਪਾਰਕਲ ਵੀ ਗਏ ਬਰਡ ਪਾਰਕ ਦੀ ਸਾਡੀ ਫਿਰ ਟਿਕਟ ਲੱਗੀ ਅਸੀਂ ਟਿਕਟ ਦੇ ਕੇ ਉੱਥੇ ਅਸੀਂ ਬਰਡ ਦੇਖੇ ਬਹੁਤ ਸਾਰੇ ਬਰਡ ਸੀਗੇ ਅਤੇ ਇਹ ਦੇਖ ਕੇ ਸਾਨੂੰ ਬਹੁਤ ਹੀ ਅੱਛਾ ਲੱਗਿਆ ਉਨ੍ਹਾਂ ਦੇ ਕਾਫੀ ਤਰ੍ਹਾਂ ਦੇ ਨਾਮ ਵੀ ਸੀਗੇ ਅਤੇ ਅਸੀਂ ਸਾਨੂੰ ਦੇਖ ਕੇ ਬਹੁਤ ਹੀ ਜ਼ਿਆਦੇ ਵਧੀਆ ਲੱਗਿਆ ਅਤੇ ਸਾਡੇ ਟੀਚਰ ਜੀ ਬਹੁਤ ਖੁਸ਼ ਸੀਗੇ ਸਾਰੇ ਬੱਚੇ ਵੀ ਬਹੁਤ ਜ਼ਿਆਦੇ ਖੁਸ਼ ਸੀਗੇ ਅਤੇ ਉਸ ਤੋਂ ਬਾਅਦ ਅਸੀਂ ਫਿਰ ਆਪਣੀ ਬੱਸ ਦੇ ਵਿੱਚ ਹੀ ਆ ਗਏ ਅਤੇ ਫਿਰ ਸਾਡੇ ਮੈਮ ਨੇ ਸਾਨੂੰ ਰਿਫਰੈਸ਼ਮੈਂਟਸ ਵੀ ਦਿੱਤੀ ਅਤੇ ਇਨ ਫਿਊਚਰ ਜੇ ਮੈਂ ਜੇ ਮੈਨੂੰ ਮੌਕਾ ਮਿਲੇਗਾ ਤਾਂ ਮੈਂ ਫਿਰ ਇਹ ਟਰਿੱਪ ਜਾਣਾ ਚਾਹੁੰਗੀ ਹੁਣ ਮੇਰੀ ਇੱਛਾ ਇਹ ਹੈ ਵੀ ਮੈਨੂੰ ਅਗਲੀ ਵਾਰ ਟਰਿੱਪ 'ਤੇ ਸਾਇੰਸ ਸਿਟੀ ਲੈ ਕੇ ਜਾਇਆ ਜਾਵੇ